ਹਾਂਜੀ ਕੀ ਹਾਲ ਨੇ ਮੈਡਮ ਬਸ ਵਧੀਆ ਵਧੀਆ ਤੁਸੀਂ ਸੁਣਾਓ ਹੋਰ ਕਿੱਦਾਂ ਲੱਗ ਰਿਹਾ ਲੁਧਿਆਣਾ ਅੱਜ ਕੱਲ੍ਹ ਫਿਰ ਨਹੀਂ ਨਹੀਂ ਮੈਡਮ ਤੁਹਾਨੂੰ ਬਹੁਤ ਅੱਛਾ ਲੱਗੇਗਾ ਆਪਣਾ ਲੁਧਿਆਣਾ ਤੁਸੀਂ ਨਵੇਂ ਨਵੇਂ ਆਏ ਹੋ ਚਲੋ ਪਹਿਲੀ ਵਾਰ ਮੁਲਾਕਾਤ ਤੁਹਾਡੀ ਗੇਮ 'ਚ ਹੋਈ ਹੈ ਅਤੇ ਹੁਣ ਕੀ ਪਲਾਨਿੰਗ ਅੱਗੇ ਅੱਜ ਕੱਲ੍ਹ ਬਿਲਕੁਲ ਬਿਲ ਮੈਡਮ ਬਹੁਤ ਵਧੀਆ ਜੀ ਲੁਧਿਆਣਾ ਬਿਲਕੁਲ ਨਾਲ ਹੀ ਮੈ ਤੁਹਾਡੇ ਲੁਧਿਆਣਾ ਤੋਂ ਸਾਰੇ ਇਸਦੇ ਨਾਲ ਨਾਲ ਹੀ ਨੇ ਮੈਡਮ ਤੁਸੀਂ ਅਗਰ ਗੱਲ ਕਰੀ ਨਾ ਮੈਂ ਤਾ ਕਹਿ ਰਿਹਾ ਬੱਚਿਆਂ ਨੂੰ ਜਾ ਕੇ ਹਸਬੈਂਡ ਨਾਲ ਜਾ ਕੇ ਮੈਂ ਪਹਿਲਾਂ ਤਾਂ ਨਾਢਾ ਸਾਹਿਬ ਗੁਰਦੁਆਰਾ ਸਾਹਿਬ ਹੁੰਦੇ ਹੋਏ ਜਾਓ ਚੰਡੀਗੜ ਰਸਤੇ ਤੋਂ ਹੈ ਨਾ ਉੱਥੋਂ ਸਾਰੇ ਹਿਲ ਸਟੇਸ਼ਨ ਸਟਾਰਟ ਹੁੰਦੇ ਨੇ ਔਰ ਉਹਦੇ ਬਾਅਦ ਅੱਗੇ ਚਲ ਜੋ ਹੁੰਦੇ ਹੋਏ ਤੁਸੀਂ ਨੀਅਰ ਤੁਹਾਨੂੰ ਪਏਗਾ ਕਸੋਲੀ ਚਲ ਜੋ ਉੱਥੋਂ ਹਾਂਜੀ ਕਸੋਲੀ ਦੇ ਨਾਲ ਹੀ ਅੱਗੇ ਸ਼ਿਮਲਾ ਚਲ ਜਾਓ ਠੀਕ ਹੈ ਮਤਲਬ ਸਾਰਾ ਅਗਰ ਹਾਂ ਹਾਂ ਬਿਲਕੁਲ ਮੇਰੇ ਖਿਆਲ ਤੋਂ ਤਿੰਨ ਘੰਟੇ ਦਾ ਰਸਤਾ ਵੀ ਨਹੀਂ ਹੈ ਢਾਈ ਤਿੰਨ ਘੰਟੇ ਰਸਤਾ ਜੀ ਇੱਧਰੋਂ ਬਿਲਕੁਲ ਬਿਲਕੁਲ ਨੀਅਰ ਜੀ ਬਿਲਕੁਲ ਲੁਧਿਆਣਾ ਤੋਂ ਮੈਂ ਫਿਰ ਕਹਿ ਰਿਹਾ ਤੁਸੀਂ ਜਿੱਦਾ ਹਿਲ ਸਟੇਸ਼ਨ ਘੁੰਮ ਕੇ ਆਉਂਦੇ ਹੋ ਨੀਅਰ ਹੀ ਆਪਣਾ ਹੁਸ਼ਿਆਰਪੁਰ ਔਰ ਫੜ ਲਓ ਹੁਸ਼ਿਆਰਪੁਰ ਰੋਡ ਤੋਂ ਸਿੱਧੇ ਹੀ ਹਿੱਸੇ ਸ਼ਾਹ ਸ਼ੁਰੂ ਹੁੰਦੇ ਨੇ ਮੈਡਮ ਉਹ ਸਾਰਾ ਹਿਮਾਚਲ ਪ੍ਰਦੇਸ਼ ਸ਼ੁਰੂ ਹੋ ਜਾਂਦਾ ਆਪਣਾ ਕੀ ਕਹਿੰਦੇ ਨੇ ਉੱਥੇ ਜਿੱਦਾਂ ਚਿੰਤਪੁਰਨੀ ਜਵਾਲਾ ਜੀ ਇਹ ਸਾਰੀਆਂ ਦੇਵੀਆਂ ਦੇ ਵੀ ਉੱਥੇ ਟੈਂਪਲ ਬਣੇ ਹੋਏ ਨੇ ਬਹੁਤ ਵਧੀਆ ਬਿਲਕੁਲ ਬਿਲਕੁਲ ਮਾਤਾ ਰਾਣੀ ਸਾਰੇ ਦਰਸ਼ਨ ਕਰਕੇ ਆਓ ਅਤੇ ਬਹੁਤ ਵਧੀਆ ਬਣਿਆ ਸੋਹਣਾ ਬਣਿਆ ਅੱਗੇ ਵੀ ਤੁਹਾਨੂੰ ਪਤਾ ਮਨਾਲੀ ਸੋਲਨ ਸਾਰੇ ਉੱਥੇ ਹੀ ਨੇ ਮੈਡਮ ਬਿਲਕੁਲ ਮੈਡਮ ਕਸੋਲੀ ਦੇਖੋ ਇੱਕ ਹਿਲ ਸਟੇਸ਼ਨ ਆ ਬੇਸਿਕਲੀ ਹਿਲ ਸਟੇਸ਼ਨ ਹੀ ਹੈ ਅਤੇ ਉਹਦੇ ਅੰਦਰ ਇੱਕ ਮੰਕੀ ਪੁਆਇੰਟ ਬਣਾਇਆ ਜੀ ਇਹਨਾਂ ਨੇ ਅੰਦਰ ਉੱਤੇ ਜਾ ਕੇ ਮੰਕੀ ਪੁਆਇੰਟ ਹੈਗਾ ਕਿ ਉਹ ਮੱਥਾ ਟੇਕ ਕੇ ਆਓ ਜੀ ਇੱਥੇ ਪਿਕਚਰ ਬਣਾਈ ਹੈ ਜਿਹਦੇ ਵਿੱਚ ਸਟਾਰਟਿੰਗ ਦੇ ਮਾਰਕੀਟ ਬਣਨੀ ਜੀ ਇੱਥੇ ਤੇ ਉੱਥੇ ਫੇਮਸ ਜਿਹੜੇ ਨੇ ਤੁਹਾਨੂੰ ਪਤਾ ਹੀ ਜਿਹੜੀ ਮ ਮੋਮੋਜ਼ ਹੋਗੇ ਹਾਂ ਹਾਂ ਹਾਂ ਹੈਰੀਟੇਜ ਮਾਰਕੀਟ ਜੀ ਇੱਥੇ ਬਹੁਤ ਵਧੀਆ ਬਣੀ ਆ ਉਹ ਨਾਲ ਹੀ ਜੀ ਉੱਥੇ ਬਿਲਕੁਲ ਮਾਰਕੀਟ ਖਾਣ ਪੀਣ ਦੀ ਵੀ ਨਾਲ ਹੀ ਬਣੀ ਹੋਈ ਹੈ ਜਿਹੜੀ ਮੋਮੋਜ਼ ਵਗੈਰਾ ਆਹ ਹੁੰਦੇ ਨੇ ਹੈ ਨਾ ਅਤੇ ਜੋ ਇਹ ਚੀਜ਼ਾਂ ਖਾਓ ਉਥੇ ਇੰਜੋਏ ਕਰੋ ਅਤੇ ਨਾਲ ਆਪਣਾ ਬਸ ਇਹੀ ਹੈ ਘੁੰਮ ਫਿਰਨ ਵੱਲ ਚੀਜ਼ਾਂ ਨੇ ਜੀ ਵਿਚ ਹੋਣੀ ਪਿਛਲੀ ਵਾਰ ਤਾਂ ਬਰਫ ਵੀ ਸੀ ਸਨੋਅ ਗਿਰੀ ਹੋਈ ਸੀ ਇੱਥੇ ਇਸ ਬਾਰੇ ਨਹੀਂ ਗਿਰੀ ਹੈ ਬਟ ਸ਼ਿਮਲਾ ਗਿਰੀ ਆ ਇਸ ਵਾਰੀ ਬਰਫ ਬਹੁਤ ਸ਼ਿਮਲਾ ਵੀ ਉਸੀ ਰਸਤੇ 'ਚ ਹੀ ਹੈ ਸਿੱਧੇ ਚਲੇ ਜੋ ਮੇਰੇ ਖਿਆਲ ਤੋਂ ਤੁਹਾਡਾ ਨਾ ਨਾ ਕਰਦੇ ਵੀ ਕਿੰਨੇ ਕਿਲੋਮੀਟਰ ਸੀਗਾ ਪੈਂਤੀ ਕਿਲੋਮੀਟਰ ਹੈ ਜੀ ਇੱਥੋਂ ਸਿਰਫ ਕਸੋਲੀ ਤੋਂ ਹਾਂ ਮਤਲਬ ਸਵਾ ਘੰਟਾ ਲਾ ਲਓ ਅਤੇ ਡੇਢ ਘੰਟਾ ਪਹੁੰਚ ਜਾਂਦਾ ਬੰਦਾ ਕਿਉਂਕਿ ਉੱਥੇ ਹਿਲ ਸਟੇਸ਼ਨ ਨਹੀਂ ਤੋਂ ਪੋਣਾ ਘੰਟਾ ਬੰਦਾ ਪਹੁੰਚ ਜਾਂਦਾ ਲੇਕਿਨ ਹਿਲ ਸਟੇਸ਼ਨ ਇੱਕ ਅੱਧਾ ਪੋਣਾ ਘੰਟਾ ਉੱਤੇ ਹੋ ਜਾਂਦਾ ਹਾਂਜੀ ਹਾਂਜੀ ਅਤੇ ਉਹ ਤੁਸੀਂ ਉੱਥੇ ਹੋਇਓ ਪੈਂਤੀ ਕਿਲੋਮੀਟਰ ਮੈਡਮ ਪੈਂਤੀ ਚਾਲ੍ਹੀ ਕਿਲੋਮੀਟਰ ਕੰਮ ਬਹੁਤ ਹੋਈ ਹੋਈ ਆ ਜੀ ਹੈ ਵੀ ਰੋਡ ਵੀ ਸਾਫ ਹੈ ਜਦੋਂ ਕਸੋਲੀ ਜਾਂਦੇ ਹੋ ਅਤੇ ਚੌੜੀ ਚੌੜੀ ਜੀ ਭੀੜੀਆਂ ਜਿਹੀਆ ਰੋਡਾਂ ਆਉਂਦੀਆਂ ਉਹ ਜਿੱਦਾਂ ਤੁਸੀਂ ਚਲ ਜੋ ਨਾ ਜਗ੍ਹਾ ਤੋਂ ਉੱਦਾ ਹੀ ਚੱਲਦੀ ਹੈ ਬਿਲਕੁਲ ਸਾਫ ਸੁਥਰੀ ਅਤੇ ਚੌੜੀ ਹੋਰ ਹੈਗੀ ਆ ਕੋਈ ਦਿੱਕਤ ਹੀ ਨਹੀਂ ਹੈਗੀ ਬਿਲਕੁਲ ਬਿਲਕੁਲ ਉਹਦੇ ਉਹਦੇ ਅੱਗੇ ਵੀ ਉਹ ਹੈਗਾ ਕੀ ਕਹਿੰਦੇ ਕੀ ਨਾਮ ਹੈ ਭੁੱਲ ਗਿਆ ਨਾਮ ਮਾਤਾ ਜੀ ਦਾ ਨਾਦੰਗਾ ਰੰਗਾ ਕੀ ਨਾਮ ਹੈਗਾ ਉੱਥੇ ਉਹ ਵੀ ਨਾਲ ਨਾਲ ਹੀ ਹੈ ਜੀ ਇਥੇ ਹਾਂ ਹਮ ਹਾਂਜੀ ਬਿਲਕੁਲ ਬਿਲਕੁਲ ਜੀ ਨਾਲ ਚਲਦੇ ਆ ਜੀ ਬਿਲਕੁਲ ਤੁਸੀਂ ਇੱਕ ਵਾਰੀ ਤਿਆਰੀ ਕਰੋ ਅਤੇ ਚਲਦੇ ਹਾਂ ਅਸੀਂ ਠੀਕ ਹੈ ਜੀ ਚਲੋ ਠੀਕ ਹੈ ਜੀ ਮੈਮ ਮਿਲਦੇ ਆ ਅਸੀਂ ਓਕੇ ਜੀ ਓਕੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ